ਹੈਲੋ ਸਤਿ ਸ਼੍ਰੀ ਅਕਾਲ ਬੇਟੇ ਹਾਂਜੀ ਹਾਂਜੀ ਬੇਟਾ ਠੀਕ ਆ ਪੁੱਤਰ ਅਤੇ ਪੈਨ ਡਰਾਈਵ ਲਿਆਉਂਦੀ ਤੁਸੀਂ ਗਾਣਿਆਂ ਦੀ ਘਰ ਰਹਿ ਗਈ ਆ ਫਿਰ ਘਰੋਂ ਮੰਗਵਾ ਲੈ ਫਿਰ ਕਿਸੇ ਤੋਂ ਕੀ ਕਹਿੰਦੇ ਫੋਨ 'ਤੇ ਪੁੱਤਰ ਉਹ ਫਿਰ ਗਾਣੇ ਸੇਵ ਤੁਹਾਨੂੰ ਕਰਨੇ ਪੈਣੇ ਪਹਿਲੇ ਹਾਂ ਪੁੱਤਰ ਉਹ ਫਿਰ ਤੁਸੀਂ ਮੰਗਵਾ ਲਉ ਜਾਂ ਤਾਂ ਅਤੇ ਫਿਰ ਕਲਾਸ 'ਚ ਆ ਜਾਇਓ ਚਲੋ ਕੋਈ ਨਹੀਂ ਪੁੱਤਰ ਫਿਰ ਅਸੀਂ ਅੱਜ ਦੂਜੇ ਸਟੈਪਾਂ ਦੀ ਪ੍ਰੈਕਟਿਸ ਕਰ ਲੈਦੇਂ ਹਾਂ ਅਤੇ ਕੱਲ੍ਹ ਫਿਰ ਤੁਹਾਡੀ ਫਿਰ ਇੱਕ ਕਲਾਸ ਲਾਵਾਂਗੇ ਠੀਕ ਹੈ ਸਰ ਜੀ ਠੀਕ ਆ ਪੁੱਤਰ ਠੀਕ ਆ ਕੱਲ੍ਹ ਪੈਨ ਡਰਾਈਵ ਯਾਦ ਨਾਲ ਲੈ ਆਈ ਫਿਰ